ਭੰਗੜਾ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ ਭੰਗੜਾ ਪੰਜਾਬ ਦੇ ਲੋਕਾਂ ਦੀ ਖੁਸ਼ੀ ਦੇ ਦਾ ਪ੍ਰਗਟਾਵਾ ਹੈ ਭੰਗੜਾ ਸਰੀਰ ਦੀ ਚੰਗੀ ਕਸਰਤ ਵੀ ਹੈ ਭੰਗੜਾ ਪਾਉਣ ਵਾਲੇ ਅਤੇ ਭੰਗੜਾ ਸਿਖਾਉਣ ਵਾਲੇ ਮੋਟਾਪੇ ਤੋਂ ਦੂਰ ਰਹਿੰਦੇ ਹਨ ਚੁਸਤ ਫੁਰਤ ਰਹਿੰਦੇ ਹਨ ਉਹਨਾਂ ਦੇ ਸਰੀਰ ਦਾ ਇੱਕ ਇੱਕ ਅੰਗ ਹਿਲਦਾ ਹੈ ਇਹ ਇੱਕ ਸਰੀਰ ਦੀ ਚੰਗੀ ਕਸਰਤ ਵੀ ਹੈ ਦਿਮਾਗੀ ਤੌਰ 'ਤੇ ਵੀ ਭੰਗੜਾ ਸਾਨੂੰ ਤੰਦਰੁਸਤੀ ਬਖਸ਼ਦਾ ਹੈ ਕਿਉਂਕਿ ਜਦੋਂ ਅਸੀਂ ਆਪਣੀ ਲੈਅ ਦੇ ਵਿੱਚ ਭੰਗੜਾ ਪਾਉਂਦੇ ਹਾਂ ਤਾਂ ਇਹ ਸਾਡੀਆਂ ਦਿਮਾਗੀ ਪਰੇਸ਼ਾਨੀਆਂ ਚਿੰਤਾਵਾਂ ਨੂੰ ਦੂਰ ਕਰਕੇ ਸਾਨੂੰ ਆਪਣੀ ਖੁਸ਼ੀ ਨੂੰ ਪ੍ਰਗਟਾਉਣ ਦਾ ਇੱਕ ਜ਼ਰੀਆ ਦਿੰਦਾ ਹੈ ਇੱਕ ਸਾਡੀ ਖੁਸ਼ੀ ਦੇ ਮਾਹੌਲ ਨੂੰ ਦਰਸਾਉਂਦਾ ਹੈ ਭੰਗੜਾ ਸਾਡੇ ਵਿਰਸੇ ਦੀ ਸੰਭਾਲ ਹੈ ਅੱਜ ਕੱਲ੍ਹ ਪੰਜਾਬ ਦੇ ਸਕੂਲਾਂ ਕੋਲਜਾਂ ਦੇ ਵਿੱਚ ਜੋ ਯੁਵਕ ਮੇਲੇ ਲੱਗਦੇ ਹਨ ਉਹਨਾਂ ਵਿੱਚ ਹੋਣ ਵਾਲੇ ਭੰਗੜੇ ਸਾਡੇ ਵਿਰਸੇ ਦੀ ਅਸਲੀ ਸੰਭਾਲ ਹੋ ਰਹੀ ਹੈ